ਹੈਲੋ ਭਾਅ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਗਗਨਦੀਪ ਸਿੰਘ ਗੱਲ ਕਰ ਰਿਹਾਂ ਜੀ ਭਾਅ ਜੀ ਮੈਂ ਤੁਹਾਡੇ ਭਗਤ ਜੀ ਰੈਸਟੋਰੈਂਟ 'ਤੇ ਦੋ ਘੰਟੇ ਪਹਿਲਾਂ ਲੰਚ ਦਾ ਔਡਰ ਦਿੱਤਾ ਸੀ ਤੁਸੀ ਕਹਿੰਦੇ ਸੀ ਕਿ ਜੋ ਤੁਹਾਡਾ ਔਡਰ ਹੈ ਇੱਕ ਘੰਟੇ ਵਿੱਚ ਡਿਲ ਡਿਲੀਵਰ ਹੋ ਜਾਵੇਗਾ ਪਰ ਦੋ ਘੰਟੇ ਹੋ ਚੁੱਕੇ ਹਨ ਜੋ ਤੁਹਾਡਾ ਔਡਰ ਹੈ ਉਹ ਨਹੀਂ ਪਹੁੰਚਿਆ ਮੈਂ ਆਪਣੇ ਰਿਸ਼ਤੇਦਾਰਾਂ ਲਈ ਜੋ ਦੁਪਹਿਰ ਦੇ ਖਾਣੇ ਦਾ ਔਡਰ ਦਿੱਤਾ ਸੀ ਮੇਰੇ ਰਿਸ਼ਤੇਦਾਰ ਵੀ ਕਾਫੀ ਲੰਬੇ ਸਮੇਂ ਤੋਂ ਵੇਟ ਕਰ ਰਹੇ ਹਨ ਸੋ ਤੁਸੀਂ ਦੱਸੋ ਕਿ ਹੁਣ ਕਿੰਨੇ ਟਾਇਮ ਵਿੱਚ ਜੋ ਔਡਰ ਹੈ ਪਹੁੰਚ ਜਾਵੇਗਾ ਧੰਨਵਾਦ